ਮੈਂ ਸਕੂਲ ਵਿੱਚ ਪੰਜਵੀਂ ਕਲਾਸ ਵਿੱਚ ਮੈਨੂੰ ਹੀ ਮੈਡਮ ਨੇ ਮੈਨੂੰ ਪ੍ਰੇਰਿਤ ਕੀਤਾ ਉਹਨੇ ਮੇਰੀ ਬਹੁਤ ਹੈਲਪ ਕੀਤੀ ਲੋੜਵੰਦ ਬੱਚਿਆਂ ਦੀ ਬਹੁਤ ਹੈਲਪ ਕਰਦੀ ਸੀ ਉਹਨੇ ਮੈਨੂੰ ਇੱਕ ਚਰਿੱਤਰਕਾਰ ਬਣਾਉਣੀ ਜਾਂ ਡਰਾਇੰਗ ਬਣਾਉਣੀ ਸਿਖਾਈ ਜੋ ਕਿ ਹਰ ਤਰ੍ਹਾਂ ਦੇ ਵਿੱਚ ਡਰਾਇੰਗ ਦੇ ਵਿੱਚ ਡਰਾਇੰਗ ਦੇ ਵਿੱਚ ਕੰਮ ਆਉਂਦੀ ਹੈ ਉਹ ਡਰਾਇੰਗ ਬਣਾਉਣ ਦੇ ਵਿੱਚ ਬਹੁਤ ਸੌਖੀ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਜਿਸ ਨਾਲ ਮੈਨੂੰ ਡਰਾਇੰਗ ਬਣਾਉਣ ਵਿੱਚ ਬਹੁਤ ਆਸਾਨੀ ਹੁੰਦੀ ਹੈ ਮੈਂ ਜਦੋਂ ਵੀ ਡਰਾਇੰਗ ਬਣਾਉਦਾ ਹਾਂ ਤੇ ਮੈਨੂੰ ਬਹੁਤ ਜਲਦੀ ਅਤੇ ਇਸ ਬਣਾਉਣੀ ਆਸਾਨ ਹੋ ਜਾਂਦੀ ਹੈ ਡਰਾਇੰਗ ਡਰਾਈਵਿੰਗ ਬਣਾਉਣ 'ਚ ਉਹਨਾਂ ਨੇ ਬਹੁਤ ਬੱਚਿਆਂ ਦੀ ਹੈਲਪ ਕੀਤੀ ਹੈ ਅਤੇ ਬਹੁਤ ਸਬਜੈਕਟਾਂ ਵਿੱਚ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰਕੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ ਜਿਸ ਕਾਰਨ ਅੱਜ ਵੀ ਉਹ ਬੱਚੇ ਕਾਫ਼ੀ ਹੁਸ਼ਿਆਰ ਅਤੇ ਹੋਣਹਾਰ ਨਿਕਲੇ ਹਨ